ਛੋਟੇ ਹੁੰਦਿਆਂ ਮੈਂ ਸਕੂਲ ਦੇ ਵਿੱਚ ਕਈ ਵਾਰ ਦੌੜਦੇ ਹੋਏ ਸੱਟਾਂ ਖਾਧੀਆਂ ਹੁਣ ਉਦੋਂ ਤਾਂ ਖੇਡਦੇ ਸਮੇਂ ਐਨਾ ਪਤਾ ਨਹੀਂ ਲੱਗਦਾ ਸੀ ਜਦੋਂ ਉਹ ਫਿਰ ਮੈਂ ਖੇਡ ਕੁੱਦ ਕੇ ਸਕੂਲ ਤੋਂ ਘਰ ਜਾਵਾਂ ਤਾਂ ਘਰ ਜਾਣ ਤੋਂ ਬਾਅਦ ਮੇਰੀ ਸੱਟਾਂ ਦੇ ਉੱਤੇ ਮੇਰੀ ਮਾਤਾ ਸਰੋਂ ਦੇ ਤੇਲ ਦੇ ਵਿੱਚ ਹਲਦੀ ਗਰਮ ਕਰਕੇ ਉਸਨੂੰ ਮੇਰੇ ਸਟ ਜਖਮਾਂ ਉੱਤੇ ਲਗਾਉਂਦੇ ਸਨ ਉਹ ਇੱਕ ਦੇਸੀ ਨੁਸਖੇ ਦੀ ਤਰ੍ਹਾਂ ਕੰਮ ਕਰਦਾ ਸੀ ਅਤੇ ਮੇਰੀ ਸੱਟਾਂ ਬਹੁਤ ਜਲਦੀ ਭਰ ਜਾਂਦੀਆਂ ਸਨ